ਮਿਸ਼ਰਤ ਮੀਡੀਆ ਦੇ ਵਿੱਚ ਉੱਦਾਂ ਦੀ ਪੇਂਟਿੰਗ ਆ ਜਾਂਦੀ ਜਿਹਦੇ ਵਿੱਚ ਆਪਾਂ ਇੱਕ ਇੱਕ ਜਾਂ ਇੱਕ ਤੋਂ ਵੱਧ ਮਾਧਿਅਮ ਜਾਂ ਸਮੱਗਰੀ ਦਾ ਪ੍ਰਯੋਗ ਕਰਕੇ ਯੂਜ ਕਰਕੇ ਆਪਾਂ ਇੱਕ ਪੇਂਟਿੰਗ ਤਿਆਰ ਕਰਦੇ ਹਾਂ ਉਸ ਦੇ ਵਿੱਚ ਕੀ ਹੁੰਦਾ ਹੈ ਕਿ ਮਤਲਬ ਉਹਦੀਆਂ ਆਪਾਂ ਤਿੰਨ ਉਦਾਹਰਨਸ ਕਹਿ ਸਕਦੇ ਹਾਂ ਜਿੱਦਾਂ ਕਿ ਕੋਲ ਕੋਲਜੀਸ ਹੋ ਗਏ ਮੂਰਤੀਆਂ ਹੋ ਗਈਆਂ ਜਾਂ ਹੋਰ ਵੀ ਮਤਲਬ ਚੀਜ਼ਾਂ ਹੈ ਨਾ ਜਿਹਨਾਂ ਨੂੰ ਮਿਲਾ ਕੇ ਆਪਾਂ ਉਹਦੀ ਪੇਂਟਿੰਗ ਤਿਆਰ ਕਰ ਸਕਦੇ ਹਾਂ ਇਹਦੇ ਵਿੱਚ ਕ ਪੇਂਟ ਇਸ ਪੇਂਟਿੰਗ ਦੇ ਵਿੱਚ ਆਪਾਂ ਸਿਰਫ ਪੇਂਟ ਦੀ ਹੀ ਨਹੀਂ ਮਤਲਬ ਕੱਪੜਾ ਕਾਗਜ਼ ਲੱਕੜੀ ਸਾਰਿਆਂ ਦਾ ਪ੍ਰਯੋਗ ਕਰਦੇ ਹਾਂ ਪਰ ਇਹ ਸਾਰੀਆਂ ਚੀਜ਼ਾਂ ਮਤਲਬ ਮਿਸ਼ਰਤ ਮੀਡੀਆ ਸਿਰਫ ਇਹਨਾਂ ਚੀਜ਼ਾਂ ਦਾ ਕਿ ਸੀਮਤ ਨਹੀਂ ਹੋਰ ਵੀ ਆਪਾਂ ਕੁਛ ਵੀ ਉਸ ਦੇ ਵਿੱਚ ਯੂਜ ਕਰ ਸਕਦੇ ਹਾਂ ਇਹਦੇ ਮਿਸ਼ਰਤ ਮੀਡੀਆ ਦੇ ਵਿੱਚ ਇਹੀ ਹੈ ਕਿ ਵੀ ਜਦੋਂ ਆਪਾਂ ਇੱਕ ਜਾਂ ਇੱਕ ਤੋਂ ਵੱਧ ਸਮੱਗਰੀਆਂ ਜਾਂ ਮਾਧਿਅਮ ਦਾ ਯੂਜ ਕਰਕੇ ਜਦੋਂ ਆਪਾਂ ਕੋਈ ਕੱਪੜਾ ਜਾਂ ਕੋਈ ਮਾਚਿਸ ਦੀਆਂ ਤਿਲੀਆਂ ਜਾਂ ਜੋ ਆਈਸਕ੍ਰੀਮ ਆਈਸਕ੍ਰੀਮ ਦੇ ਉਹ ਜਿਹੜੇ ਡੰਡੇ ਹੁੰਦੇ ਆ ਉਹਨਾਂ ਨੂੰ ਲਗਾ ਕੇ ਜਦੋਂ ਆਪਾਂ ਕੋਈ ਪੇਂਟਿੰਗ ਤਿਆਰ ਕਰਦੇ ਹਾਂ ਤਾਂ ਉਹਨੂੰ ਮਿਸ਼ਰਤ ਮੀਡੀਆ ਵਾਲੀ ਪੇਂਟਿੰਗ ਕਹਿ ਦਿੰਦੇ ਆ ਹੁਣ ਜਿੱਦਾਂ ਮੈਂ ਆਪਦੀ ਇੱਕ ਮਤਲਬ ਐਕਸਪੀਰੀਅੰਸ ਸ਼ੇਅਰ ਕਰਾਂ ਮੈਂ ਇੱਕ ਟਾਈਮ ਮਤਲਬ ਬਣਾਈ ਸੀਗੀ ਪੇਂਟਿੰਗ ਪਹਿਲਾਂ ਮੈਂ ਨੋਰਮਲ ਹੈ ਨਾ ਡਰੋਅ ਕਰ ਲਿਆ ਫਿਰ ਉਸ ਤੋਂ ਬਾਅਦ ਮੈਂ ਹੱਟ ਜੋ ਆਪਾਂ ਬਣਾਉਂਦੇ ਹਾਂ ਅਤੇ ਉਹਦੇ 'ਤੇ ਮੈਂ ਆਹ ਕੁਲਫੀ ਵਾਲੇ ਜਿਹੜੇ ਡੰਡੇ ਹੁੰਦੇ ਉਹਨਾਂ 'ਤੇ ਲਗਾ ਕੇ ਜਾਂ ਹੋਰ ਵੀ ਜਿਹੜੇ ਮਾਚਿਸ ਦੀਆਂ ਤਿਲੀਆਂ ਦਾ ਵੀ ਉਸ ਪੇਂਟਿੰਗ 'ਚ ਪ੍ਰਯੋਗ ਕੀਤਾ ਪਹਿਲਾਂ ਇੱਕ ਸੀਨਰੀ ਬਣਾ ਕੇ ਰਿਵਰ ਦੀ ਜਗ੍ਹਾ ਦੇ ਉੱਤੇ ਮੈਂ ਬਲੂ ਕਲਰ ਦਾ ਕੱਪੜਾ ਲਾ ਦਿੱਤਾ ਬਲੂ ਜਾਂ ਲਾਈਟ ਬਲੂ ਇੱਦਾਂ ਦਾ ਕੋਂਬੀਨੇਸ਼ਨ ਜਿਹਾ ਬਣਾ ਕੇ ਉਹਦੀ ਜਗ੍ਹਾ 'ਤੇ ਮੈਂ ਕੱਪੜਾ ਲਗਾ ਦਿੱਤਾ ਬਾਕੀ ਜਿੱਥੇ ਪੇਂਟ ਕਰਨ ਦੀ ਜ਼ਰੂਰਤ ਸੀ ਮੈਂ ਪੇਂਟ ਕੀਤਾ ਉਸ ਚੀਜ਼ ਨੂੰ ਹਾਈਲਾਈਟ ਕੀਤਾ ਕਲਰਿੰਗ ਕੀਤੀ ਅਤੇ ਇੱਦਾਂ ਕਰਕੇ ਜਿਹੜੇ ਰਿਵਰ ਦੇ ਬੰਨ ਸੀਗੇ ਉਹਨਾਂ ਦੇ ਉੱਪਰ ਮੈਂ ਉਹ ਲਗਾ ਦਿੱਤਾ ਇੱਕ ਰੱਸੀ ਲਗਾ ਦਿੱਤੀ ਇੱਦਾਂ ਕਰਕੇ ਮੈਂ ਉਸ ਪੇਂਟਿੰਗ ਨੂੰ ਬਣਾਇਆ ਸੀ ਅਤੇ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਸੀਗਾ ਮੇਰਾ ਅਤੇ ਮੈਨੂੰ ਬਹੁਤ ਮਜ਼ਾ ਆਇਆ ਸੀਗਾ ਉਹਨੂੰ ਬਣਾ ਕੇ ਅਤੇ ਉਹ ਦੇਖਣ ਨੂੰ ਵੀ ਬਹੁਤ ਅਟਰੈਕਟਿਵ ਲੱਗ ਰਹੀ ਸੀ ਨਾਲੇ ਕੁਛ ਵ ਨਵਾਂ ਐਕਸਪੀਰੀਅੰਸ ਕਰਨ ਦਾ ਮੌਕਾ ਮਿਲਿਆ ਸੀ ਥੈਂਕ ਯੂ